ਟੈਕਨੋਲਜੀ ਨੇ ਹਰ ਥਾਂ ਵਿੱਚ ਸਾਡੀ ਮਦਦ ਕੀਤੀ ਹੈ ਚਾਹੇ ਉਹ ਡਾ ਡਾਕਟਰ ਲੱਭਣ ਵਿੱਚ ਹੋਏ ਚਾਹੇ ਉਹ ਕਲੀਨਿਕ ਲੱਭਣ ਵਿੱਚ ਹੋਏ ਅਗਰ ਸਾਨੂੰ ਥੋੜਾ ਬਹੁਤਾ ਹੀ ਬਿਮਾਰੀ ਹੋਵੇ ਅਸੀਂ ਔਨਲਾਈਨ ਹੀ ਡਾਕਟਰ ਤੋਂ ਪੁੱਛ ਸਕਦੇ ਹਾਂ ਅਤੇ ਉਹ ਸਾਨੂੰ ਦਵਾਈ ਦੱਸ ਦਿੰਦਾ ਹੈ ਨਾਲ ਦੀ ਨਾਲ ਅਸੀਂ ਦਵਾਈ ਵੀ ਘਰੇ ਬਹਿ ਕੇ ਹੀ ਔਨਲਾਈਨ ਔਡਰ ਕਰ ਸਕਦੇ ਹਾਂ ਜਿਵੇਂ ਕਿ ਅਗਰ ਸਾਨੂੰ ਕੋਈ ਬਿਮਾਰੀ ਹੋਵੇ ਜਿਸਦੀ ਬ ਦਵਾਈ ਸਾਨੂੰ ਪਤਾ ਹੋਵੇ ਤਾਂ ਅਸੀਂ ਦੁਕਾਨ ਤੋਂ ਉਹ ਦਵਾਈ ਮੰਗਾ ਸਕਦੇ ਹਾਂ ਅਤੇ ਜੇ ਸਾਨੂੰ ਕੋਈ ਵੀ ਕਲੀਨਿਕ ਢੂੰਡਣਾ ਹੋਵੇ ਤਾਂ ਉਹਦਾ ਐਡਰੈੱਸ ਔਨਲਾਈਨ ਸਾਨੂੰ ਮਿਲ ਜਾਂਦਾ ਹੈ ਜਿਸ ਦੇ ਨਾਲ ਅਸੀਂ ਫੋਨ ਕਰਕੇ ਜਾਣ ਤੋਂ ਪਹਿਲਾਂ ਹੀ ਅਪੁਆਇੰਟਮੈਂਟ ਲੈ ਲੈਂਦੇ ਹਨ